ਮੈਦਾਨ ਵਿੱਚ ਖੇਡਾਂ ਖੇਡਦਿਆਂ ਖਿਡਾਰੀਆਂ ਨੂੰ ਆਮ ਹੀ ਸੱਟਾਂ ਲੱਗਦੀਆਂ ਰਹਿੰਦੀਆਂ ਨੇ ਸਾਡੇ ਖੇਤਰ ਵਿੱਚ ਜੇ ਕੋਈ ਖੇਡਣ ਖੇਡ ਖੇਡਣ ਦੇ ਦੌਰਾਨ ਜ਼ਖਮੀ ਹੋ ਜਾਂਦਾ ਹੈ ਤਾਂ ਸਰਕਾਰ ਵੱਲੋਂ ਉਸ ਖਿਡਾਰੀ ਨੂੰ ਕਾਫੀ ਸਹੂਲਤ ਦਿੱਤੀਆਂ ਜਾਂਦੀਆਂ ਹਨ ਕਈ ਵਾਰ ਕਈ ਖਿਡਾਰੀ ਖੇਡ ਦੌਰਾਨ ਕੁਝ ਜ਼ਿਆਦਾ ਹੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਣ 'ਤੇ ਦੁਬਾਰਾ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਲਿਆਉਣ ਲਈ ਕਈ ਸਰਕਾਰ 'ਤੇ ਨੇ ਜੋ ਮਦਦ ਕਰਦੀ ਹੈ ਉਹ ਤਾਂ ਹੈ ਪਰ ਸਾਡੇ ਇਲਾਕੇ ਦੇ ਲੋਕ ਵੀ ਇਸ ਤਰ੍ਹਾਂ ਦੇ ਖਿਡਾਰੀਆਂ ਦੀ ਮਦਦ ਵੱਧ ਚੜ੍ਹ ਕੇ ਕਰਦੇ ਹਨ ਇਹਨਾਂ ਖਿਡਾਰੀਆਂ ਦਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਂਦਾ ਹੈ ਇਨ ਉਹਨਾ ਨੂੰ ਪੈਸੇ ਦੇ ਪੱਖੋਂ ਵੀ ਕਾਫੀ ਮਦਦ ਕੀਤੀ ਜਾਂਦੀ ਹੈ ਤਾਂ ਜੋ ਉਹ ਤੰਦਰੁਸਤ ਹੋ ਕੇ ਫਿਰ ਖੇਡ ਖੇਡ ਸਕਣ